ਭੰਗੜੇ ਦੀ ਕੁਛ ਆਮ ਸਟੈਪ ਜਿਵੇਂ ਸ਼ਿੰਗਲ ਸ਼ਾਟਾ ਡਬਲ ਸ਼ਾਂਟਾ ਤਾੜੀ ਮੋਰਪੰਖੀ ਹਨ ਇਹ ਜਿਹੜਾ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਯਾਨੀ ਕਿ ਜਦੋਂ ਆਪਾਂ ਨੱਚਦੇ ਹਾਂ ਟੱਪਦੇ ਹਾਂ ਜਸ਼ਨ ਹੱਸਦੇ ਖੇਡਦੇ ਖੁਸ਼ੀ ਖੁਸ਼ੀ ਇਸ ਨਾਲ ਆਪਣਾ ਸੁਭਾਅ ਚੇਂਜ ਹੁੰਦਾ ਅਤੇ ਇਹ ਜਿਹੜਾ ਭੰਗੜਾ ਇਹ ਖੁਸ਼ੀ ਦੇ ਮੌਕੇ 'ਤੇ ਜਿਵੇਂ ਲੋਹੜੀ ਦੇ ਪ੍ਰੋਗਰਾਮ 'ਤੇ ਵਿਆਹਾਂ 'ਤੇ ਇੱਦਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ 'ਤੇ ਇਹ ਪਾਇਆ ਜਾਂਦਾ ਭੰਗੜਾ ਪੰਜਾਬ ਦਾ ਇੱਕ ਸਭ ਤੋਂ ਮਸ਼ਹੂਰ ਡਾਂਸ ਕਹਿ ਸਕਦੇ ਹਾਂ ਵੀ ਭੰਗ ਉਹ ਹੈ ਆਪਣਾ ਸੱਭਿਆਚਾਰ ਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਹਿੱਸਾ ਹੈ ਭੰਗੜਾ ਸਾਡੇ ਪੰਜਾਬੀ ਸੱਭਿਆਚਾਰ ਦਾ ਅਤੇ ਭੰਗੜਾ ਕਰਨ ਨਾਲ ਅਸੀਂ ਫਿੱਟ ਵੀ ਰਹਿੰਦੇ ਹਾਂ ਕਿਉਂਕਿ ਭੰਗੜੇ ਨਾਲ ਬਹੁਤ ਸਾਰੀ ਐਕਸਰਸਾਈਜ਼ ਹੁੰਦੀ ਹੈ ਜਦੋਂ ਅਸੀਂ ਨੱਚ ਪੂਰਾ ਜਦੋਂ ਅਸੀਂ ਭੰਗੜਾ ਪਾਉਂਦੇ ਹਾਂ ਤਾਂ ਸਾਡੀ ਪੂਰੀ ਬਾਡੀ ਦੀ ਐਕਸਰਸਾਈਜ਼ ਹੁੰਦੀ ਹੈ ਨੱਚਦੇ ਟੱਪਦੇ ਹਾਂ ਸਾਨੂੰ ਪਸੀਨਾ ਬਹੁਤ ਆਉਂਦਾ ਅਸੀਂ ਫਿਟ ਰਹਿੰਦੇ ਹਾਂ ਅਤੇ ਨਾਲੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਮਿਲਦੀ ਹੈ ਭੰਗੜਾ ਪਾਉਣ ਨਾਲ ਅਸੀਂ ਫਰੀ ਮਾਇੰਡ ਹੋ ਜਾਂਦੇ ਹਾਂ